ਪ੍ਰਾਚੀਨ ਮੱਧ ਕਾਲੀਨ ਦੌਰ ਵਿੱਚ ਬਹੁਤ ਸਾਰੇ ਰਾਜੇ ਮਸ਼ਹੂਰ ਹੈਗੇ ਸੀਗੇ ਜਿੰਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਮਹਾਰਾਜਾ ਰਣਜੀਤ ਸਿੰਘ ਹੈਗੇ ਸੀ ਜਿਹੜੇ ਮਾਹਾਰਾਜਾ ਰਣਜੀਤ ਸਿੰਘ ਸੀ ਉਹ ਖਾਲਸਾ ਸਮਰਾਜ ਵਿੱਚ ਪਹਿਲੇ ਰਾਜੇ ਸੀ ਉਹ ਸ਼ੇਰੇ ਪੰਜਾਬ ਦੇ ਨਾਮ ਨਾਲ ਪ੍ਰਸਿੱਧ ਸੀਗੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਜਿਹੜੇ ਅੰਗਰੇਜ਼ ਸੀ ਉਹਨਾਂ ਦਾ ਰਾਜ ਨਹੀਂ ਚੱਲਣ ਦਿੱਤਾ ਇੱਕ ਵਾਰ ਜਿਹੜਾ ਸਾਰਾ ਪੰਜਾਬ ਸਾਰੇ ਪੰਜਾਬ ਦੇ ਵਿੱਚ ਨਾ ਸੋਕਾ ਪਿਆ ਸੀਗਾ ਮੀਂਹ ਨਹੀਂ ਪੈਣ ਦਿਆ ਜਿਹਦਾ ਕਰਕੇ ਲੋਕਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਖਰਾਬ ਹੋਣ ਲੱਗ ਪਈਆਂ ਫਿਰ ਬਾਅਦ ਚੋਂ ਲੋਕਾਂ ਨੂੰ ਅਨਾਜ ਲੈਣ ਵਾਸਤੇ ਇੱਕ ਦੂਜੇ 'ਤੇ ਡਿਪੈਂਡ ਹੋਣਾ ਪੈਣ ਦਿਆ ਸੀਗਾ ਫਿਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਨੇ ਗਰੀਬਾਂ ਦੀ ਸਹਾਇਤਾ ਕੀਤੀ ਉਹਨਾਂ ਨੇ ਆਪਣੇ ਅੰਨ ਦਾ ਭੰਡਾਰ ਖੋਲਿਆ ਮਤਲਬ ਉਹਨਾਂ ਤੋਂ ਜਿੰਨਾ ਅਨਾਜ ਸੀਗਾ ਉਹਨਾਂ ਨੇ ਸਾਰਾ ਹੀ ਗਰੀਬਾਂ 'ਚ ਵੰਡਤਾ ਫਿਰ ਜਿਹਦੇ ਨਾਲ ਕਿ ਜਿਹੜੇ ਗਰੀਬ ਸੀ ਉਹਨਾਂ ਦੇ ਘਰ ਦਾ ਗੁਜ਼ਾਰਾ ਹੋ ਗਿਆ ਅਤੇ ਬਜ਼ੁਰਗ ਜਿਹਾ ਇੱਕ ਬਜ਼ੁਰਗ ਉਹਨਾਂ ਤੋਂ ਆਪਦੀ ਅਨਾਜ ਦੀ ਬੋਰੀ ਨਹੀਂ ਚੁੱਕੀ ਜਾਣ ਦਈ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਲਿਬਾਸ ਬਦਲਿਆ ਅਤੇ ਉਹ ਉਹਦੀ ਅਨਾਜ ਦੀ ਉਹ ਬਜ਼ੁਰਗ ਦੀ ਅਨਾਜ ਦੀ ਬੋਰੀ ਚੁੱਕ ਕੇ ਉਹਦੇ ਘਰ ਛੱਡ ਕੇ ਆਏ ਅਤੇ ਉਹ ਜਿਹੜਾ ਬਜ਼ੁਰਗ ਸੀਗਾ ਉਹ ਸਾਰੇ ਰਾਹ ਹੀ ਮਹਾਰਾਜਾ ਰਣਜੀਤ ਸਿੰਘ ਦੀ ਤਰੀਫਾਂ ਕਰਦਾ ਰਿਹਾ ਅਤੇ ਮੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਉਹ ਨਿਮਰਤਾ ਗਰੀਬਾਂ ਦੀ ਹ ਮਦਦ ਕਰਨਾ ਇਹ ਆਕਰਸ਼ਿਤ ਕਰਦਾ ਆ